ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਸੁਣਾਓ ਠੀਕ ਹੈ ਹਾਂਜੀ ਅੱਛਾ ਮਤਲਬ ਡਿਵਲਮੈਂਟ ਬਾਰੇ ਪੁੱਛਣਾ ਹਾਂਜੀ ਹੁੰ ਹਾਂਜੀ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਜਿਹੜਾ ਵਿਕਾਸ ਹੋਇਆ ਹੈ ਜਿੱਦਾਂ ਵਾਟਰ ਸਪਲਾਈ ਇਲੈਕਟਰਿਸਿਟੀ ਅਤੇ ਰੋਡ ਦਾ ਅਤੇ ਪਹਿਲਾਂ ਜਿੱਦਾਂ ਕਿ ਹਾਂਜੀ ਹੁਸ਼ਿਆਰਪੁਰ ਦੇ ਰੋਡ ਜਿਹੜੇ ਸੀਗੇ ਟੁੱਟੇ ਸੀਗੇ ਸੜਕਾਂ ਦੀ ਮੁਰੰਮਤ ਨਹੀਂ ਸੀ ਠੀਕ ਢੰਗ ਨਾਲ ਹੋ ਰਹੀ ਅਤੇ ਹੁਣ ਤਾਂ ਇੱਦਾਂ ਅੱਜ ਕੱਲ੍ਹ ਜਿੱਦਾਂ ਬਹੁਤ ਵਧੀਆ ਰੋਡ ਬਣ ਗਏ ਆ ਜਿੱਦਾਂ ਅਤੇ ਫਿਰ ਜਿਹੜੇ ਤੁਸੀਂ ਪਾਣੀ ਦਾ ਜਿਹੜਾ ਨਿਕਾਸ ਆ ਉਹ ਵੀ ਠੀਕ ਢੰਗ ਦੇ ਨਾਲ ਨਹੀਂ ਹੋ ਰਿਹਾ ਸੀਗਾ ਜਿੱਦਾਂ ਕਿ ਉਹ ਪਾਈਪ ਵਗੈਰਾ ਨਹੀਂ ਪਾਏ ਸੀਗੇ ਜਿੱਦਾਂ ਹੁਣ ਉਹਨਾਂ ਨੇ ਜਿੱਦਾਂ ਪਾਣੀ ਦਾ ਵੀ ਵਿਕਾਸ ਦਾ ਜਿਹੜਾ ਸੀਗਾ ਨਾ ਉਹ ਵੀ ਠੀਕ ਢੰਗ ਨਾਲ ਕਰ ਦਿੱਤਾ ਹੈ ਅਤੇ ਪਾਈਪ ਵਗੈਰਾ ਜਿੱਦਾਂ ਮਤਲਬ ਪਾ ਪਾ ਦਿੱਤੇ ਆ ਜਿੱਦਾਂ ਅਤੇ ਉਹ ਵੀ ਮਤਲਬ ਠੀਕ ਹੋ ਗਿਆ ਆ ਜਿੱਦਾਂ ਹੁਣ ਮਤਲਬ ਪਾਣੀ ਦਾ ਵਿਕਾਸ ਜਿਹੜਾ ਮਤਲਬ ਠੀਕ ਢੰਗ ਨਾਲ ਹੋ ਰਿਹਾ ਜਿਹੜਾ ਅਤੇ ਇਸ ਤੋਂ ਇਲਾਵਾ ਜਿਹੜਾ ਵਾਟਰ ਸਪਲਾਈ ਆ ਉਹ ਵੀ ਪਹਿਲਾਂ ਮਤਲਬ ਠੀਕ ਨਹੀਂ ਸੀਗਾ ਵਾਟਰ ਦਾ ਪੂਰੀ ਤਰ੍ਹਾਂ ਮਤਲਬ ਪ੍ਰਬੰਧ ਨਹੀਂ ਸੀਗਾ ਜਿੱਦਾਂ ਅਤੇ ਹੁਣ ਜਿੱਦਾਂ ਪਾਣੀ ਉਹਦਾ ਪਾਣੀ ਦਾ ਜਿਹੜਾ ਠੀਕ ਢੰਗ ਨਾਲ ਡਿਵੈਲਪਮੈਂਟ ਹੋਈ ਹੈ ਜਿੱਦਾਂ ਅਤੇ ਹਾਂਜੀ ਪਹਿਲਾਂ ਪਾਣੀ ਜਿਹੜਾ ਸਾਫ਼ ਸੁਥਰਾ ਨਹੀਂ ਸੀਗਾ ਜਿੱਦਾਂ ਮਤਲਬ ਅਤੇ ਹੁਣ ਅੱਜ ਕੱਲ੍ਹ ਜਿਹੜਾ ਪਾਣੀ ਨੂੰ ਸਾਫ਼ ਕਰਨ ਦੇ ਲਈ ਬਹੁਤ ਜ਼ਿਆਦਾ ਜਿੱਦਾਂ ਪ੍ਰਬੰਧ ਕੀਤੇ ਗਏ ਆ ਅਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਹਰ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿਹੜਾ ਇੱਕ ਸਿਸਟਮ ਲਾਗੂ ਕੀਤਾ ਗਿਆ ਜਿੱਦਾਂ ਸਰਕਾਰ ਵੱਲੋਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਆ ਜਿੱਦਾਂ ਕਿ ਉਹ ਮਤਲਬ ਹਾਂਜੀ ਵੱਡੀ ਟੈਂਕੀ ਮਤਲਬ ਹੁੰਦਾ ਉਹਦੇ ਤੋਂ ਜਿੱਦਾਂ ਦੋ ਤਿੰਨ ਪਿੰਡਾਂ ਨੂੰ ਪਾਣੀ ਜਾਂਦਾ ਆ ਉਹ ਹਰ ਹਰ ਥਾਵਾਂ 'ਤੇ ਜਿੱਦਾਂ ਕਿ ਪਿੰਡਾਂ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਤੇ ਲੋਕਾਂ ਨੇ ਉਹ ਮਤਲਬ ਕਰਵਾਈਆਂ ਆ ਉਹ ਜਿੱਦਾਂ ਉਹਨਾਂ ਦਾ ਬੋਰ ਲਗਵਾ ਕਰਵਾਇਆ ਆ ਅਤੇ ਉਹ ਸਵੇਰੇ ਸ਼ਾਮ ਪਾਣੀ ਆ ਜਾਂਦਾ ਅਤੇ ਉਹ ਸਾਫ਼ ਸੁਥਰਾ ਪਾਣੀ ਹੁੰਦਾ ਹੈ ਜੀ ਹਾਂਜੀ ਹਾਂਜੀ ਹਾਂਜੀ ਪਹਿਲਾਂ ਕੇ ਜੇ ਪਹਿਲਾਂ ਪਹਿਲਾਂ ਵਾਲੇ ਸਮੇਂ 'ਚ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਿਜਲੀ ਠੀਕ ਢੰਗ ਦੇ ਨਾਲ ਨਹੀਂ ਆ ਰਹੀ ਸੀ ਜਿੱਦਾਂ ਕਿ ਗਰਮੀਆਂ ਨੂੰ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਬਹੁਤ ਜ਼ਿਆਦਾ ਕੱਟ ਲਗਾਉਂਦੇ ਸੀ ਜਿੱਦਾਂ ਪੂਰੇ ਪੂਰੇ ਦਿਨ ਦਾ ਕੱਟ ਲਗਾ ਲਗਾਉਣਾ ਹੈ ਨਾ ਅਤੇ ਜਿੱਦਾਂ ਕੋਈ ਕੋਈ ਮੌਸਮ ਵਗੈਰਾ ਖਰਾਬ ਹੋ ਜਾਂਦਾ ਸੀਗਾ ਤਾਂ ਵੀ ਦੋ ਦੋ ਦਿਨ ਮਤਲਬ ਬਿਜਲੀ ਨਹੀਂ ਦਿੰਦੇ ਸੀਗੇ ਬਟ ਹੁਣ ਮਤਲਬ ਇਹ ਪ੍ਰੇਸ਼ਾਨੀ ਤੋਂ ਕਾਫ਼ੀ ਜ਼ਿਆਦਾ ਜਿੱਦਾਂ ਰਾਹਤ ਮਿਲ ਗਈ ਆ ਅਤੇ ਹੁਣ ਜਿੱਦਾਂ ਮਤਲਬ ਟਵੈਂਟੀ ਫੋਰ ਆਵਰਸ ਕਹਿ ਸਕਦੇ ਹਾਂ ਵੀ ਬਿਜਲੀ ਈਂ ਆਉਂਦੀ ਆ ਜਿੱਦਾਂ ਅਤੇ ਮਤਲਬ ਕਦੇ ਕਿਤੇ ਜਾਂਦੀ ਆ ਜਿੱਦਾਂ ਕਿ ਥੋੜ੍ਹਾ ਬਹੁਤਾ ਮੌਸਮ ਖਰਾਬ ਹੋਵੇ ਨਾ ਤਾਂ ਉਸ ਟਾਈਮ 'ਤੇ ਜਾਂਦੀ ਆ ਜਿੱਦਾਂ ਇਕ ਘੰਟਾ ਇਕ ਦੋ ਘੰਟੇ ਦੇ ਲਈ ਮਤਲਬ ਇੱਦਾਂ ਨਹੀਂ ਵੀ ਦੋ ਦੋ ਤਿੰਨ ਤਿੰਨ ਦਿਨ ਹੁਣ ਬਿਜਲੀ ਜਿਹੜੀ ਬੰਦ ਰਹਿੰਦੀ ਆ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਅੱਜ ਕੱਲ੍ਹ ਜਿੱਦਾਂ ਮਤਲਬ ਤੁਹਾਨੂੰ ਪਤਾ ਹੀ ਸਰਕਾਰ ਦੀ ਜਿਹੜੀ ਸਕੀਮ ਆ ਉਹਦੇ ਅਕੋਰਡਿੰਗ ਜਿੱਦਾਂ ਹੈਨਾ ਉਹਨਾਂ ਨੇ ਯੂਨਿਟਾਂ ਬਣਾ ਦਿੱਤੀਆਂ ਆ ਮਤਲਬ ਕਈ ਲੋਕਾਂ ਦਾ ਤਾਂ ਜੀਰੋ ਬਿਲ ਆ ਰਿਹਾ ਆ ਇਸ ਟਾਈਮ 'ਤੇ ਮਤਲਬ ਕਿ ਅਸੀਂ ਆਪਣੀ ਯੂਨਿਟ ਤੋਂ ਬਾਹਰ ਜਾਵਾਂਗੇ ਹੈ ਨਾ ਜਿਆਦਾ ਚੀਜ਼ਾਂ ਯੂਜ ਕਰਾਂਗੇ ਉਹ ਮਤਲਬ ਉਹ ਜਿਹੜੀ ਉਹਨਾਂ ਨੇ ਲਿਮਿਟ ਦਿੱਤੀ ਆ ਉਹਤੋਂ ਪਾਰ ਹੋ ਜਾਊਗਾ ਤਾਂ ਸਾਡਾ ਬਿੱਲ ਆਊਗਾ ਅਦਰਵਾਈਜ਼ ਸਭ ਲੋਕਾਂ ਦੇ ਜਿਹੜੇ ਮਤਲਬ ਬਿੱਲ ਜਿਹੜੇ ਜੀਰੋ ਆ ਰਹੇ ਆ ਮਤਲਬ ਇਹ ਮੈਂ ਕਹਿੰਦੀ ਹਾਂ ਵੀ ਇਹ ਸਰਕਾਰ ਨੇ ਬਹੁਤ ਵਧੀਆ ਜਿਹੜਾ ਉਪਰਾ ਉਪਰਾਲਾ ਕੀਤਾ ਆ ਹਾਂਜੀ ਹਾਂਜੀ ਉੱਦਾਂ ਮਤਲਬ ਨੋਟ ਐਗਰੀ ਵਿੱਦ ਯੂਅਰ ਸਟੇਟਮੈਂਟ ਮਤਲਬ ਮੈਂ ਥੋੜ੍ਹੀ ਬਹੁਤ ਐਗਰੀ ਕਰਦੀ ਹਾਂ ਮਤਲਬ ਸੰਤੁਸ਼ਟ ਤਾਂ ਹੈਗੀ ਹਾਂ ਪਰ ਮੈਂ ਇਹ ਚਾਹੁੰਦੀ ਹਾਂ ਵੀ ਜਿਹੜੀ ਡਿਵੈਲਪਮੈਂਟ ਹੁਣ ਹੋ ਰਹੀ ਆ ਇਹਦੇ ਤੋਂ ਜ਼ਿਆਦਾ ਹੋਰ ਵੀ ਡਿਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਸਾਡਾ ਮਤਲਬ ਜਿਹੜਾ ਸ਼ਹਿਰ ਆ ਹੈ ਨਾ ਉਹ ਬਾਕੀ ਸ਼ਹਿਰਾਂ ਦੇ ਮੁਕਾਬਲੇ ਆ ਮੁਕਾਬਲੇ ਮਤਲਬ ਵਧੀਆ ਹੋਵੇ ਹਾਂਜੀ ਅਤੇ ਜਿੱਦਾਂ ਕਿ ਪਾਣੀ ਹਾਂਜੀ ਪਾਣੀ ਦਾ ਵੀ ਬਹੁਤ ਜ਼ਿਆਦਾ ਮਤਲਬ ਠੀਕ ਢੰਗ ਨਾਲ ਹੋਰ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਆ ਜਿੱਦਾਂ ਬਿਜਲੀ ਦਾ ਵੀ ਹੋਰ ਜ਼ਿਆਦਾ ਹੋਣਾ ਚਾਹੀਦਾ ਆ ਅਤੇ ਬਾਕੀ ਜਿਹੜਾ ਰੋਡ ਦਾ ਜਿਹੜਾ ਹੈ ਨਾ ਉਹ ਵੀ ਥੋੜ੍ਹਾ ਜ਼ਿਆਦਾ ਹੀ ਨਹੀਂ ਹੋਣਾ ਚਾਹੀਦਾ ਆ ਜਿਹੜਾ ਟਰੈਫਿਕ ਵਗੈਰਾ ਹੈ ਨਾ ਉਹਦੇ ਵਿੱਚ ਥੋੜ੍ਹਾ ਸੁਧਾਰ ਹੋਣਾ ਚਾਹੀਦਾ ਆ ਓਕੇ ਥੈਂਕ ਯੂ ਜੀ ਠੀਕ ਹੈ ਜੀ ਥੈਂਕ ਯੂ